ਹਾਂਜੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਮੇਰੀ ਬਾਈਕਿੰਗ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਿਉਂਕਿ ਮੈਂ ਵਧਦੀ ਮਹਿੰਗਾਈ ਦੇ ਨਾਲ ਘਰ ਦੇ ਖਰਚੇ ਵੀ ਉਡੇ ਹੀ ਜ਼ਿਆਦਾ ਵੱਧ ਰਹੇ ਹਨ ਪਰ ਪੰਜਾਬ ਸਰਕਾਰ ਰੋਜ਼ਗਾਰ ਨਹੀਂ ਦੇ ਰਹੀ ਹੈ ਜਿਸ ਨਾਲ ਘਰ ਵਿੱਚ ਆਮਦਨੀ ਓਡੀ ਹੀ ਜ਼ਿਆਦਾ ਘੱਟ ਹੈ ਇਸ ਕਰਕੇ ਬਹੁਤ ਸਾਰੀਆਂ ਹੋਰ ਵੀ ਦਿੱਕਤਾਂ ਆਉਂਦੀਆਂ ਹਨ ਜਿਵੇਂ ਕਿ ਬਿਜਲੀ ਦੇ ਬਿੱਲ ਭਰਨੇ ਹੁੰਦੇ ਆ ਘਰ ਦੇ ਹੋਰ ਵੀ ਬਹੁਤ ਸਾਰੇ ਖਰਚੇ ਕੱਢਣੇ ਹੁੰਦੇ ਹਨ ਇਸ ਲਈ ਅਸੀਂ ਪੈਟਰੋਲ 'ਤੇ ਓਡਾ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਅਤੇ ਹੋਰ ਵੀ ਬਹੁਤ ਸਾਰੀਆਂ ਸਾਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਜਿੱਦਾਂ ਕਿ ਪੈਟਰੋਲ ਪਿਊਰੀਫਾਈ ਨਹੀਂ ਮਿਲਦਾ ਜਿਸ ਕਰਕੇ ਬਾਈਕ ਮਾਈਲੇਜ ਵੀ ਘੱਟ ਦਿੰਦੀ ਹੈ ਇਸ ਲਈ ਸਾਡਾ ਪੈਟਰੋਲ 'ਤੇ ਹੋਰ ਜ਼ਿਆਦਾ ਖਰਚਾ ਵੱਧਦਾ ਹੈ ਅਗਰ ਅਸੀਂ ਪੈਟਰੋਲ ਖਰੀਦਣਾ ਸਾਡੀ ਇੱਕ ਮਜਬੂਰੀ ਹੈ ਇਸ ਲਈ ਸਾਨੂੰ ਸਾਡੀ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕੀ ਪੈਟਰੋਲ ਦੀਆਂ ਕੀਮਤਾਂ ਨੂੰ ਘਟਾਇਆ ਜਾਏ ਜਿਸ ਨਾਲ ਅਸੀਂ ਆਪਣੀ ਬਾਈਕਿੰਗ ਨੂੰ ਸਹੀ ਤਰੀਕੇ ਨਾਲ ਉਪਯੋਗ ਕਰ ਸਕੀਏ